ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਰ ਜੀ ਜ਼ਰੂਰ ਸਰ ਜੀ ਜੀ ਜੀ

ਠੀਕ ਆ ਸਰ ਜੀ ਇਸ ਵੇਲੇ ਬੀਜ਼ੀ ਬਹੁਤ ਹਾਂ ਪਰ ਮੈਂ ਤੁਹਾਨੂੰ ਥੋੜ੍ਹਾ ਸੰਖੇਪ ਵਿੱਚ ਦੱਸ ਦਿੰਦੀ ਹਾਂ ਹਾਂਜੀ ਹਾਂਜੀ ਹਾਂਜੀ ਬਿਲਕੁਲ ਜੀ ਸਰ ਐਕਚੁਲੀ ਇਹ ਹੈ ਕਿ ਇਹ ਅੰਗਰੇਜ਼ਾਂ ਦੇ ਜਦੋਂ ਇੱਥੇ ਰਾਜ ਸੀ ਉਦੋਂ ਦਾ ਬਣਿਆ ਹੋਇਆ ਠੀਕ ਹੈ ਅਤੇ ਨਾਨਕਸ਼ਾਹੀ ਇੱਟਾਂ ਦੇ ਨਾਲ਼ ਬਣਿਆ ਹੋਇਆ ਅਤੇ ਇਹ ਬਹੁਤ ਪੁਰਾਤਨ ਜਿਹੜੀ ਜ਼ਿਲ੍ਹਾ ਇਮਾਰਤ ਹੈਗੀ ਆ ਅਤੇ ਇਹਦੇ ਵਿੱਚ ਜਿਹੜੀਆਂ ਵੱਡੀਆਂ ਵੱਡੀਆਂ ਸਖਸ਼ੀਅਤਾਂ ਪੜ੍ਹ ਕੇ ਗਈਆਂ ਨੇ ਹੁਣ ਵੀ ਇਸ ਟਾਈਮ 'ਤੇ ਸਭ ਤੋਂ ਵੱਡੀ ਜਿਹੜੀ ਇਮਾਰਤ ਹੈ ਉਹ ਹੈ ਖਾਲਸਾ ਕੋਲੇਜ ਦੀ ਹੈ ਖਾਲਸਾ ਕੋਲੇਜ ਨੇ ਆਪਣੀ ਹੀ ਜਗ੍ਹਾ ਦੇ ਵਿੱਚੋਂ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਈ ਦਿੱਤੀ ਦੇ ਨਾਲ਼ ਚਲਾ ਰਹੇ ਨੇ ਠੀਕ ਹੈ ਅਤੇ ਬਹੁਤ ਵੱਡੀਆਂ ਵੱਡੀਆਂ ਸਖਸ਼ੀਅਤਾਂ ਇੱਥੋਂ ਪੜ੍ਹ ਕੇ ਗਈਆਂ ਅਤੇ ਨਾਲ਼ੇ ਸਰ ਇਹਨੂੰ ਸੌ ਸਾਲ ਤੋਂ ਉੱਪਰ ਹੋ ਗਿਆ ਠੀਕ ਹੈ ਬਾਹਰੋਂ ਵੀ ਬ ਕਿੰਨਾ ਇੱਥੇ ਵਿਦਿਆਰਥੀ ਪੜ੍ਹਨ ਆਉਂਦੇ ਨੇ ਇੱਥੋਂ ਤੱਕ ਅੰਮ੍ਰਿਤਸਰ ਦੇ ਨਹੀਂ ਜਾਂ ਸਿਰਫ ਪੰਜਾਬ ਦੇ ਨਹੀਂ ਹਿੰਦੁਸਤਾਨ ਦੇ ਹੋਰ ਵੀ ਇਲਾਕਿਆਂ 'ਚੋਂ ਅਤੇ ਬਾਹਰੋਂ ਫੋਰਨ 'ਚੋਂ ਵੀ ਇੱਥੇ ਪੜ੍ਹਨ ਆਉਂਦੇ ਨੇ ਹਾਂਜੀ ਹਾਂਜੀ ਸਰ ਦੇਖੋ ਐਡੀ ਵੱਡੀ ਸੰਸਥਾ ਹੈਗੀ ਇਹਨਾਂ ਨੇ ਆਪਣੇ ਆਪ ਦੇ ਵਿੱਚ ਆਪਣੇ ਆਪ ਨੂੰ ਸੈਲਫ ਸਫੀਸ਼ੀਐਂਸੀ ਸ਼ੋਅ ਕੀਤਾ ਅਤੇ ਇਹਨਾਂ ਨੂੰ ਸੈਲਫ ਅੋਟੋਨੋਮਸ ਦਾ ਮਤਲਬ ਇੰਸਟੀਟਿਊਟ ਹੋਣ ਦਾ ਇੱਕ ਦਰਜਾ ਮਤਲਬ ਕਿ ਨੈਕ ਵੱਲੋਂ ਇਹਨਾਂ ਨੂੰ ਏ ਪਲੱਸ ਦਾ ਦਰਜਾ ਮਿਲਿਆ ਹੋਇਆ ਠੀਕ ਹੈ ਜੀ ਨਾਲ਼ ਸਰ ਜੀ ਤੁਸੀਂ ਖਾਲਸਾ ਕੋਲੇਜ ਦੀ ਫੋਟੋ ਜ਼ਰੂਰ ਛਾਪਿਓ ਠੀਕ ਹੈ ਜੀ ਚਲੋ ਓਕੇ ਓਕੇ ਜੀ ਓਕੇ ਮਿਹਰਬਾਨੀ ਜੀ